ਸਾਡੇ ਇਲਾਕੇ ਦੀਆਂ ਸ ਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਜਿਹਨਾਂ ਦੇ ਮੁੱਖ ਮ ਮੁੱਖ ਮੰਤਰੀ ਭਗਵੰਤ ਮਾਨ ਔਰ ਮੇਨ ਕੇਜਰੀਵਾਲ ਜੀ ਔਰ ਅਕਾਲੀ ਦਲ ਜਿਹਨਾਂ ਦੇ ਮੁੱਖ ਪ੍ਰਮੁੱਖ ਹੈਗੇ ਹਨ ਸੁਖਬੀਰ ਸਿੰਘ ਬਾਦਲ ਔਰ ਕਾਂਗਰਸ ਜਿਹਨਾਂ ਦੇ ਰਾਜਾ ਵੜਿੰਗ ਰਾਜਾ ਵੜਿੰਗ ਔਰ ਅੱਜ ਕੱਲ੍ਹ ਜੋ ਸਾਡੇ ਐੱਮ ਐੱਲ ਏ ਹਨ ਅਨਮੋਲ ਗਗਨ ਮਾਨ